ਸਰ ਆਰ ਕੇ ਬਾਇਸੈਕਲ ਤੋਂ ਬੋਲਦੇ ਹੋ ਭਾਅ ਜੀ ਆਪਣਾ ਬੱਚਿਆਂ ਨੂੰ ਜੀ ਸਾਈਕਲ ਪੁੱਛਣਾ ਸੀਗਾ ਸਾਈਕਲ ਤੁਹਾਡੇ ਕੋਲ ਕਿਹੜੇ ਕਿਹੜੇ ਹੈਗੇ ਨੇ ਓਕੇ ਸੌਲ੍ਹਾਂ ਇੰਚੀ ਬੱਚਿਆਂ ਲਈ ਮੈਂ ਬਾਰਾਂ ਸਾਲ ਦਾ ਬੱਚਾ ਮੇਰਾ ਉਸ ਲਈ ਸੌਲ੍ਹਾਂ ਇੰਚੀ ਠੀਕ ਰਹੇਗਾ ਕਿ ਚੌਦ੍ਹਾਂ ਇੰਚੀ ਸਾਈਕਲ ਠੀਕ ਰਹੇਗਾ ਅੱਛਾ ਅਤੇ ਚੌਦ੍ਹਾਂ ਇੰਚੀ 'ਚ ਕਿਹੜੇ ਕਿਹੜੇ ਫੀਚਰ ਨੇ ਉਹ 'ਚ ਗੇਰਾਂ ਵਾਲਾ ਸਾਈਕਲ ਵੀ ਹੁੰਦਾ ਹੈਗੇ ਤੁਹਾਡੇ ਕੋਲ ਅਵੇਲੇਬਲ ਓਕੇ ਕੀ ਕੀ ਪ੍ਰਾਈਜ਼ ਆ ਉਹਦਾ ਓਕੇ ਅਤੇ ਉਸ ਤੋਂ ਬਾਅਦ ਜੇ ਸੌਲ੍ਹਾਂ ਇੰਚੀ ਦਾ ਲੈਣਾ ਹੋਵੇ ਉਹਦੇ 'ਚ ਕਿੰਨਾਂ ਕੁ ਪ੍ਰਾਈਸ ਦਾ ਡਿਫਰੈਂਸ ਹੈ ਠੀਕ ਹੈ ਉਕੇ ਅੱਛਾ ਡਿਸਕਾਊਂਟ ਵੀ ਆਪਣਾ ਕੁਝ ਹੈ ਤੁਹਾਡੇ ਕੋਲ ਅਵੇਲੇਬਲ ਠੀਕ ਹੈ ਫਿਰ ਵੀ ਥੋੜ੍ਹਾ ਜਿਹਾ ਅੱਛਾ ਥੋੜ੍ਹਾ ਜਿਹਾ ਡਿਸਕਾਊਂਟ ਕਰੋ ਤਾਂਹੀ

ਓਕੇ ਇੱਕ ਆਪਣਾ ਹਾਂਜੀ

ਓਕੇ ਅਤੇ ਜੇ ਦੋ ਸਾਈਕਲ ਇਕੱਠੇ ਲੈਣੇ ਹੋਣ ਉਹ 'ਤੇ ਕੋਈ ਡਿਸਕਾਊਂਟ ਵਗੈਰਾ ਬੈਟਰੀ ਵਾਲਾ ਸਾਈਕਲ ਵੀ ਹੁੰਦਾ ਤੁਹਾਡੇ ਕੋਲ ਚਲੋ ਠੀਕ ਹੈ ਜੀ ਤੁਹਾਨੂੰ ਅਸੀਂ ਦੱਸਦੇ ਹਾਂ ਫਿਰ ਥੈਂਕ ਯੂ